ਬਚਪਨ ਦੀਆਂ ਮਨਪਸੰਦ ਯਾਦਾਂ ਜਾਂ ਸਾਨੂੰ ਆਪਣਾ ਪਾਗਲਪਨ ਕਹਿ ਲਈਏ ਮੈਂ ਸ਼ਾਇਦ ਬਾਰ੍ਹਾਂ ਜਾਂ ਤੇਰ੍ਹਾਂ ਸਾਲ ਦਾ ਸੀ ਮੇਰਾ ਵੱਡਾ ਭਰਾ ਜੋ ਬਹੁਤ ਸ਼ਰਾਰਤੀ ਸੀ ਇੱਕ ਵਾਰ ਖੇਡਦਾ ਹੋਇਆ ਛੱਤ ਤੋਂ ਡਿੱਗ ਗਿਆ ਫਿਰ ਉਹ ਆਪਣੀ ਲੱਤ ਨੂੰ ਪਲਸਤਰ ਲਵਾ ਕੇ ਉਸਨੂੰ ਤੋੜ ਕੇ ਬੈਠ ਗਿਆ ਉਹਨਾਂ ਦੀ ਮਹਿਮਾਨ ਨਿਵਾਜੀ ਪੂਰਾ ਮਹੀਨਾ ਲੱਗੇ ਜਿਵੇਂ ਰਾਜਾ ਮਾਨ ਸਿੰਘ ਜੀ ਸਾਡੇ ਘਰ ਆਏ ਹੋਣ ਹਰ ਦੋ ਦਿਨ ਬਾਅਦ ਅਧਿਆਪਕ ਸਕੂਲ ਤੋਂ ਆ ਕੇ ਉਸਨੂੰ ਪੜ੍ਹਾਉਂਦਾ ਸੀ ਤਾਂ ਜੋ ਆਪਣੀ ਜਮਾਤ ਵਿੱਚ ਪਿੱਛੇ ਨਾ ਰਹਿ ਜਾਵੇ ਹਰ ਰੋਜ਼ ਉਸਦੇ ਦੋਸਤ ਆ ਕੇ ਗੱਲਾਂ ਕਰਦੇ ਉਸ ਦੀ ਮਾਂ ਉਸ ਨੂੰ ਗਰਮ ਨਾਸ਼ਤਾ ਪਰੋਸਦੀ ਮਹਿਮਾਨਾਂ ਦੀ ਆਮਦ ਸੀ ਮੈਂ ਮਨ ਹੀ ਮਨ ਸੋਚਦਾ ਸੀ ਵਾਹ ਭਈ ਕਿਆ ਮਜ਼ਾ ਹੈ ਅਤੇ ਉਸ ਪਲ ਮੈਂ ਫੈਸਲਾ ਕੀਤਾ ਕਿ ਮੈਂ ਵੀ ਅਜਿਹਾ ਕਾਰਨਾਮਾ ਕਰਾਂ ਇੱਕ ਵਾਰ ਮੈਂ ਝੂਲਾ ਝੂਲ ਰਿਹਾ ਸੀ ਅਤੇ ਅਚਾਨਕ ਮੇਰੇ ਮਨ ਵਿੱਚ ਖਿਆਲ ਆਇਆ ਜੇ ਮੈਂ ਸਵਿੰਗ ਨੂੰ ਬਹੁਤ ਸਖਤ ਸਵਿੰਗ ਕਰਦਾ ਹਾਂ ਤਾਂ ਹੋ ਸਕਦਾ ਹੈ ਕਿ ਮੈਂ ਆਪਣੇ ਆਪ 'ਤੇ ਕਾਬੂ ਨਾ ਰੱਖ ਸਕਾਂ ਮੇਰੀ ਬਾਂਹ ਟੁੱਟ ਜਾਵੇ ਮੇਰਾ ਭਰਾ ਮੇਰੇ ਚਾਚੇ ਦਾ ਮੁੰਡਾ ਉੱਥੇ ਖੜ੍ਹਾ ਸੀ ਇਸ ਲਈ ਮੈਂ ਉਸ ਨੂੰ ਜ਼ੋਰ ਨਾਲ ਝੂਲਣ ਲਈ ਕਿਹਾ ਉਹ ਝੂਲ ਰਿਹਾ ਸੀ ਅਤੇ ਮੈਂ ਹੋਰ ਹੋਰ ਹੋਰ ਅਤੇ ਏ ਨਾਰੇ ਲਾਉਂਦਾ ਰਿਹਾ ਝੂਲ ਰਿਹਾ ਸੀ ਆਖਿਰਕਾਰ ਮੇਰਾ ਹੱਥ ਜ਼ੋਰ ਨਾਲ ਦਬਾਇਆ ਗਿਆ ਅਤੇ ਮੈਂ ਇੱਕ ਝਟਕੇ ਨਾਲ ਡਿੱਗ ਪਿਆ ਫਿਰ ਕੀ ਸੀ ਮੈਂ ਵੀ ਉਸ 'ਤੇ ਡਿੱਗ ਪਿਆ ਮੇਰਾ ਗਰੀਬ ਭਰਾ ਮੇਰੇ ਹੱਥ ਟੁੱਟਣ ਦੀ ਪ੍ਰਕਿਰਿਆ ਮੈਂ ਉਸਦੀਆਂ ਲੱਤਾਂ ਤੋੜ ਦਿੱਤੀਆਂ ਅੱਜ ਵੀ ਜਦੋਂ ਭੈਣ ਭਰਾ ਮਿਲਦੇ ਹਾਂ ਪਹਿਲਾਂ ਹੀ ਪੁੱਛ ਲੈਂਦੇ ਹਨ ਭੈਣ ਭਰਾ ਜੀ ਦੱਸੋ ਹੁਣ ਤੁਸੀਂ ਕਿਹੜਾ ਪਾਗਲਪਨ ਕਰਨਾ ਹੈ ਤਾਂ ਜੋ ਮੈਂ ਆਪਣੇ ਆਪ ਨੂੰ ਬਚਾ ਸਕਾਂ